ਅੱਠ ਲੱਖ ਦੋ ਹਜ਼ਾਰ ਛੇ ਸੌ ਬੱਤੀ ਪੰਜਾਹ ਹਜ਼ਾਰ ਪੱਚੀ ਛੇ ਹਜ਼ਾਰ ਸੱਤ ਸੌ ਬਾਨਵੇਂ ਦੋ ਲੱਖ ਪੰਜ ਹਜ਼ਾਰ ਚਾਰ ਸੌ ਵੀਹ ਚਾਰ ਲੱਖ ਬਾਨਵੇਂ ਹਜ਼ਾਰ ਅੱਸੀ